ਹਾਂ ਖੇਡਾਂ ਨਾਲ ਲੋਕਾਂ ਦਾ ਸਟਰੈਸ ਦੂਰ ਰਹਿੰਦ ਹੁੰਦਾ ਹੈ ਅਤੇ ਉਹਨਾਂ ਨੂੰ ਬਹੁਤ ਜ਼ਿਆਦਾ ਆਨੰਦ ਮਿਲਦਾ ਹੈ ਅਤੇ ਖੇਡਾਂ ਖੇਡਣ ਦੀ ਕੋਈ ਵੀ ਉਮਰ ਨਹੀਂ ਹੁੰਦੀ ਕਿਉਂਕਿ ਖੇਡਾਂ ਅ ਬੱਚੇ ਵੀ ਖੇਡ ਸਕਦੇ ਹਨ ਲੋਕ ਜਾਂ ਕੋਈ ਵੀ ਖੇਡ ਸਕਦਾ ਹੈ ਅ ਜ ਜਦੋਂ ਬੱਚੇ ਖੇਡ ਖੇਡਦੇ ਹਨ ਖੇਡ ਖੇਡਦੇ ਹਨ ਤਾਂ ਉਹ ਬਹੁਤ ਹੀ ਜ਼ਿਆਦਾ ਖੁਸ਼ ਹੁੰਦੇ ਹਨ ਅਤੇ ਉਹਨਾਂ ਨੂੰ ਬਹੁਤ ਜ਼ਿਆਦਾ ਆਨੰਦ ਮਿਲਦਾ ਹੈ ਜਦੋਂ ਉਹ ਆਪਸ ਵਿੱਚ ਦੋਸਤ ਇਕੱਠੇ ਹੁੰਦੇ ਹਨ ਜਦੋਂ ਬੱਚਿਆਂ ਨੂੰ ਬਹੁਤ ਜ਼ਿਆਦਾ ਸਕੂਲ ਹੋਮਵਰਕ ਮਿਲਦਾ ਹੈ ਤਾਂ ਉਹਨਾਂ ਨੂੰ ਬਹੁਤ ਜ਼ਿਆਦਾ ਸਟਰੈਸ ਹੁੰਦਾ ਹੈ ਅਤੇ ਅਤੇ ਉਹ ਸਟਰੈਸ ਤੋਂ ਫਰੀ ਹੋਣ ਲਈ ਆਪਣੇ ਦੋਸਤਾਂ ਨਾਲ ਖੇਡਦੇ ਹਨ ਅਤੇ ਆਪਣਾ ਮਾਇੰਡ ਫਰੈਸ਼ ਕਰਨ ਲਈ ਅ ਜਾਂ ਤਾਜਾ ਕਰਨ ਲਈ ਉਹ ਖੇਡਾਂ ਖੇਡਦੇ ਹਨ ਅਤੇ ਜਿਹਨਾਂ ਨਾਲ ਉਹਨਾਂ ਨੂੰ ਬਹੁਤ ਜਿਆਦਾ ਖੁਸ਼ੀ ਮਿਲਦੀ ਹੈ ਅਤੇ ਉਹਨਾਂ ਨੂੰ ਖੇਡਣਾ ਵੀ ਚਾਹੀਦਾ ਹੈ ਨਹੀਂ ਤਾਂ ਬੱਚੇ ਸਾਰਾ ਦਿਨ ਮੋਬਾਇਲ 'ਤੇ ਗੇਮਜ਼ ਹੀ ਖੇਡਦੇ ਰਹਿੰਦੇ ਹਨ ਅਤੇ ਉਹਨਾਂ ਦੀਆਂ ਅੱਖਾਂ ਵੀ ਖ਼ਰਾਬ ਹੋ ਜਾਂਦੀਆਂ ਹਨ ਜਿਹਨਾਂ ਨਾਲ ਉਹਨਾਂ ਨੂੰ ਬਹੁਤ ਜ਼ਿਆਦਾ ਬਿਮਾਰੀਆਂ ਲੱਗਦੀਆਂ ਹਨ ਖੇਡਾਂ ਖੇਡਣ ਨਾਲ ਅ ਬਹੁ ਕੋਈ ਵੀ ਸਰੀਰਕ ਅਤੇ ਮਾਨਸਿਕ ਬਿਮਾਰੀ ਨਹੀਂ ਲੱਗਦੀ ਸਰੀਰ ਤੰਦਰੁਸਤ ਰਹਿੰਦਾ ਹੈ ਅਤੇ ਬੱਚੇ ਵੀ ਖੁਸ਼ ਰਹਿੰਦੇ ਹਨ ਖੇ ਖੇਡਾਂ ਸਾਡੇ ਲਈ ਬਹੁਤ ਹੀ ਜਰੂਰੀ ਹੈ ਸਾਨੂੰ ਸਟਰੈ ਸਾਡਾ ਸਟਰੈਸ ਵੀ ਦੂਰ ਕਰਦੀਆਂ ਹਨ ਅਤੇ ਖੇਡਾਂ ਖੇਡਣ ਨਾਲ ਅਸੀਂ ਖੁਸ਼ ਵੀ ਰਹਿੰਦੇ ਹਨ ਅਤੇ ਸਾਨੂੰ ਬਹੁਤ ਜ਼ਿਆਦਾ ਆਨੰਦ ਵੀ ਮਿਲਦਾ ਹੈ ਕਈ ਖੇਡਾਂ ਤਾਂ ਐਹ ਜਿਹੀਆਂ ਹੁੰਦੀਆਂ ਹਨ ਜੋ ਕਿ ਸਾਨੂੰ ਵਾਰ ਵਾਰ ਖੇਡਣ ਨੂੰ ਜੀਅ ਕਰਦਾ ਹੈ ਅਤੇ ਖੇਡਾਂ ਖੇਡ ਕੇ ਜਦੋਂ ਬੱਚੇ ਘਰ ਵਾਪਸ ਆਉਂਦੇ ਹਨ ਤਾਂ ਉਹ ਆਪਣਾ ਕੰਮ ਕਰਦੇ ਹਨ ਤਾਂ ਉਹਨਾਂ ਨੂੰ ਕੰਮ ਕਰਨ ਵਿੱਚ ਕੋਈ ਵੀ ਸਟਰੈਸ ਫੀਲ ਨਹੀਂ ਹੁੰਦਾ ਅਤੇ ਖੁਸ਼ੀ ਖੁਸ਼ੀ ਆਪਣਾ ਕੰਮ ਕਰਦੇ ਹਨ ਬੱਚਿਆਂ ਲਈ ਖੇਡਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਨਾ ਕਿ ਬੱਚਿਆਂ ਲਈ ਸਭ ਲਈ ਹੀ ਖੇਡਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਖੇਡਾਂ ਦੀ ਕੋਈ ਵੀ ਉਮਰ ਨਹੀਂ ਹੁੰਦੀ ਖੇਡਾਂ ਕੋਈ ਵੀ ਖ ਕੋਈ ਵੀ ਖੇਡ ਸਕਦਾ ਹੈ ਲੋਕ ਬੱਚੇ ਜਾਂ ਕੋਈ ਵੀ ਬਜ਼ੁਰਗ ਨੌਜਵਾਨ ਕੋਈ ਵੀ ਖੇਡ ਸਕਦਾ ਹੈ